ਦੌੜਨ ਵੇਲੇ ਸਾਨੂੰ ਵੱਖ ਵੱਖ ਮੌਸਮੀ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਗਰਮੀ ਵਿੱਚ ਦੌੜਨ ਲੱਗੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਪਾਣੀ ਦਾ ਪੂਰਾ ਬੰਦੋਬਸਤ ਹੋਏ ਅਸੀਂ ਦੁਪਹਿਰ ਜਦੋਂ ਕਿ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ ਹੈ ਉਸ ਸਮੇਂ ਨਾ ਦੌੜੀਏ ਸਵੇਰੇ ਸਵੇਰੇ ਜਾਂ ਫਿਰ ਸ਼ਾਮ ਨੂੰ ਜਦੋਂ ਕਿ ਮੌਸਮ ਥੋੜ੍ਹਾ ਠੰਡਾ ਹੁੰਦਾ ਹੈ ਉਸ ਸਮੇਂ ਦੌੜੀਏ ਠੰਡ ਵਿੱਚ ਵੀ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਦੌੜਨ ਤੋਂ ਪਹਿਲਾਂ ਕੁਝ ਕਸਰਤਾਂ ਐਕਸਾਈਜ ਕਰ ਲਈ ਜਾਵੇ ਤਾਂ ਜੋ ਸਹੀ ਢੰਗ ਨਾਲ ਦੌੜਿਆ ਜਾਵੇ ਬਰਸਾਤ ਵਿੱਚ ਆਮ ਤੌਰ 'ਤੇ ਨਹੀਂ ਦੌੜਨਾ ਚਾਈਦਾ ਕਿਉਂਕਿ ਦੌੜਨ ਵੇਲੇ ਕਈ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਚੋਟ ਲੱਗਣਾ ਆਦਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ